ਸਾਡੇ ਪੰਜਾਬੀ ਵਿਰਸੇ ਵਿੱਚ ਬਹੁਤ ਕੁਝ ਹੈਗਾ ਜਿਵੇਂ ਲੋਕ ਗੀਤ ਇਹਦੇ ਵਿੱਚੋਂ ਵੀ ਬਹੁਤ ਖ਼ਾਸ ਹੈਗੇ ਹੈ ਜਿਵੇਂ ਲੋਕ ਗੀਤ ਹੈਗੇ ਹੈ ਪੰਜਾਬ ਦੇ ਲੋਕ ਗੀਤ ਹੈਗੇ ਆ ਜਿਵੇਂ ਘੋੜੀਆਂ ਸੁਹਾਗ ਜਿਵੇਂ ਘੋੜੀਆਂ ਹੁੰ ਹੈਗੀਆਂ ਉਹ ਜਿਵੇਂ ਮੁੰਡੇ ਦਾ ਵਿਆਹ ਹੈਗਾ ਉਹਦੇ ਵਿੱਚ ਗਾਈਆਂ ਜਾਂਦੀਆਂ ਸੁਹਾਗ ਜਿਹੜਾ ਹੈਗਾ ਉਹ ਕੁੜੀ ਦੇ ਵਿਆਹ 'ਚ ਗਾਇਆ ਜਾਂਦਾ ਜਿਵੇਂ ਇਸੇ ਤਰ੍ਹਾਂ ਹੀ ਸਿੱਠਣੀਆਂ ਛੰਦ ਪਰਾਗਾ ਛੱਲਾ ਟੱਪੇ ਜਿਵੇਂ ਜਨਮ ਗੀਤ ਹੈਗੇ ਜਨਮ 'ਤੇ ਜਿਹੜੇ ਗੀਤ ਗਾਏ ਜਾਂਦੇ ਛੱਲਾ ਟੱਪੇ ਬੋਲੀਆਂ ਲੋਰੀਆਂ ਲੋਹੜੀ ਦੇ ਗੀਤ ਜਿਵੇਂ ਲੋਹੜੀ ਦੇ ਗੀਤ ਜਿਵੇਂ ਗਾਏ ਜਾਂਦੇ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ ਦੁੱਲ ਭੱਟੀ ਵਾਲਾ ਹੋ ਜਿਵੇਂ ਲੋਹੜੀ ਦੀ ਗੀਤਾਂ ਦੇ ਤੌਰ 'ਤੇ ਗਏ ਜਾਂਦੇ ਜਿਵੇਂ ਕਿੱਕਲੀ ਜਿਵੇਂ ਕੁੜੀਆਂ ਹੈਗੀਆਂ ਜਿਹੜੀਆਂ ਕਿੱਕਲੀ ਪਾਉਦੀਆਂ ਐਗੀਆਂ ਅਤੇ ਕਿੱਕਲੀ ਪਾਉਂਦੀਆਂ ਦੋ ਕੁੜੀਆਂ ਰਲ ਕੇ ਕਿੱਕਲੀ ਪਾਉਦੀਆਂ ਇਹ ਜਿਵੇਂ ਭੰ ਜਿਵੇਂ ਆਪਣੇ ਗਿੱਧੇ 'ਚ ਸ਼ਾਮਿਲ ਕਰ ਸਕਦੇ ਹਾਂ ਜਿਵੇਂ ਥਾਲ ਹੁੱਲੇ ਹੁਲਾਰੇ ਲੋਕ ਗੀਤ ਚੇਤ ਚੇਤਰ ਨਾ ਜਾਈਂ ਚੰਨਾ ਖਿੜੀ ਬਹਾਰ ਵੇ ਚੇਤਰ ਨਾ ਜਾਈਂ ਚੰਨਾ ਖਿੜੀ ਬਹਾਰੇ ਵੇ ਵਿਸਾਖ ਨਾ ਜਾਈਂ ਚੰਨਾ ਹੀਰੀਏ ਨੀ ਰਹੀਏ ਨੀ ਰਸ ਭਰੀਏ ਖਜ਼ੂਰੇ ਰਹੀਏ ਨੀ ਰਸ ਭਰੀਏ ਖਜ਼ੂਰੇ ਇਹ ਵੀ ਸਾਡੇ ਲੋਕ ਗੀਤ ਹੈ ਇੱਕ ਤਰ੍ਹਾਂ ਦਾ ਉਚਰਾ ਬੁਰਜ ਲਾਹੌਰ ਦਾ ਇਹ ਵੀ ਸਾਡਾ ਹੈਗਾ ਲੋਕ ਗੀਤ ਉਚੜਾ ਬੁਰਜ ਲਾਹੌਰ ਦਾ ਜਿਵੇਂ ਕਹਿੰਦੇ ਆ ਵੀ ਚੀਰੇ ਵਾਲਿਆ ਹੇਠ ਵਗੇ ਦਰਿਆ ਵੇ ਸੱਜਣ ਮੇਰਿਆ ਮਲ ਮਲ ਠਾਵਣ ਗੋਰੀਆਂ ਵੇ ਚੀਰੇ ਵਾਲਿਆ ਲੈਣ ਰੱਬ ਦਾ ਨਾਂ ਵੇ ਸੱਜਣ ਮੇਰਿਆ ਵੇ ਪਿੱਪਲਾ ਤੂੰ ਆਪ ਵੱਡਾ ਇਹ ਵੀ ਇੱਕ ਤਰ੍ਹਾਂ ਇੱਕ ਤਰ੍ਹਾਂ ਦਾ ਹੈ ਲੋਕ ਗੀਤ ਵੇ ਪਿੱਪਲਾ ਤੂੰ ਆਪ ਵੱਡਾ ਪਰਿਵਾਰ ਵੱਡਾ ਅਤੇ ਪੱਤਿਆਂ ਨੇ ਸ਼ੈਬਰ ਲਾਈ ਪੱਤਿਆਂ ਨੇ ਸ਼ੈਬਰ ਲਾਈ ਕਣਕਾਂ ਅਤੇ ਛੋਲਿਆਂ ਦਾ ਖੇਤ ਕਣਕਾਂ ਅਤੇ ਛੋਲਿਆਂ ਦਾ ਖੇਤ ਹੌਲੀ ਹੌਲੀ ਨਿਸਰੇਂਗਾ ਹੌਲੀ ਹੌਲੀ ਨਿਸਰੇਂਗਾ ਹਾਏ ਓ ਓਏ ਮੇਰੇ ਡਾਢਿਆ ਰੱਬਾ ਮਧਾਣੀਆਂ ਹਾਏ ਓਏ ਮੇਰੇ ਡਾਢਿਆ ਰੱਬਾ ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਅੱਜ ਦੀ ਦਿਹਾੜੀ ਮੈਨੂੰ ਰੱਖ ਡੋਲੀ ਨੀ ਮਾਂ ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ ਰਵਾਂ ਬਾਬਲ ਦੀ ਬਣ ਕੇ ਗੋਲੀ ਨੀ ਮਾਂ ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ ਜਿਵੇਂ ਇਹ ਸੁਰਿੰਦਰ ਕੌਰ ਦਾ ਗਾਇਆ ਸੁਰਿੰਦਰ ਕੌਰ ਇੱਕ ਵਧੀਆ ਲੋਕ ਗਾਇਕ ਸੀ ਜਿਸ ਨੇ ਬਹੁਤ ਤਰ੍ਹਾਂ ਦੇ ਵਧੀਆ ਗੀਤ ਗਾਏ ਹੈ ਅਤੇ ਉਹ ਬਹੁਤ ਫੇਮਸ ਵੀ ਰਹੀ ਆ ਉਹਨਾਂ ਦੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਸੋ ਸਾਰੇ ਲੋਕ ਗੀਤ ਹਨ ਲੋਕ ਗੀਤ ਹਨ ਸਾਡਾ ਚਿੜੀਆਂ ਦਾ ਚੰਬਾ ਵੇ ਅਸਾਂ ਹੁਣ ਉੱਡ ਜਾਣਾ